ਮੈਂ ਖਾਣ ਵਿੱਚ ਜ਼ਿਆਦਾਤਰ ਮਿੱਠੇ ਪਕਵਾਨਾਂ ਨੂੰ ਹੀ ਤਰਜੀਹ ਦਿੰਦਾ ਹਾਂ ਮਿੱਠੇ ਪ ਪਕਵਾਨ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹਨ ਇਹਨਾਂ ਵਿੱਚੋ ਖਾਸਕਰ ਖੀਰ ਪੂੜੇ ਮੈਨੂੰ ਸਭ ਤੋਂ ਜ਼ਿਆਦਾ ਮਨ ਭਾਉਂਦੇ ਆ ਕਿਉੰਕਿ ਇਹ ਬਹੁਤ ਹੀ ਜ਼ਿਆਦਾ ਪੋਸ਼ਟਿਕ ਅਤੇ ਵਧੀਆ ਹੁੰਦੇ ਹਨ ਇਹਨਾਂ ਨੂੰ ਖਾਣ ਦਾ ਸਭ ਤੋਂ ਵਧੀਆ ਮੌਸਮ ਬਰਸਾਤੀ ਮੌਸਮ ਹੈ ਈ ਪੰਜਾਬ ਵਿੱਚ ਜ਼ਿਆਦਾਤਰ ਖੀਰ ਪੂੜੇ ਸਾਉਣ ਦੇ ਮਹੀਨੇ ਵਿੱਚ ਬਣਦੇ ਹਨ ਇਹ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਆ ਅਤੇ ਇਹਨਾਂ ਨੂੰ ਖਾ ਕੇ ਮੈਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਇਸਨੂੰ ਬਣਾਉਣ ਦੀ ਵਿਧੀ ਵੀ ਬਹੁਤ ਹੀ ਸੋਖੀ ਹੈ ਸਭ ਤੋਂ ਪਹਿਲਾਂ ਇ ਖੀਰ ਤਿਆਰ ਕੀਤੀ ਜਾਂਦੀ ਹੈ ਜੋ ਚੌਲ ਅਤੇ ਦੁੱਧ ਨਾਲ ਬਣਾਈ ਜਾਂਦੀ ਹੈ ਅਤੇ ਚੀਨੀ ਜਾਂ ਸ਼ੱਕਰ ਨਾਲ ਇਸਨੂੰ ਮਿਠਾਸ ਦਿੱਤੀ ਜਾਂਦੀ ਹੈ ਅਤੇ ਪੁੜੇ ਤਿਆਰ ਕਰਨ ਲਈ ਪਾਣੀ ਵਿੱਚ ਸ਼ੱਕਰ ਨੂੰ ਰਲਾ ਕੇ ਉਸ ਉਸਦਾ ਆਟੇ ਨਾਲ ਲੇਪ ਬਣ ਬਣਾਇਆ ਜਾਂਦਾ ਹੈ ਜਿਸਨੂੰ ਤਵੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਰਾੜ੍ਹਿਆ ਜਾਂਦਾ ਹੈ